ਹੈਲੋ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਜੀ ਹਾਂਜੀ ਠੀਕ ਹਾਂਜੀ ਠੀਕ ਠਾਕ ਵਧੀਆ ਹੋਰ ਘਰ ਪਰਿਵਾਰ ਵਧੀਆ ਜੀ ਹਾਂਜੀ ਬੱਚੇ ਠੀਕ ਨੇ ਬਸ ਬਾਹਰ ਗਏ ਹੋਏ ਨੇ ਜੀ ਉਹ ਦੋਵੇਂ ਬੇਟੇ ਜੀ ਉਹ ਬਾਹਰ ਚਲੇ ਗਏ ਜੀ ਹਾਂਜੀ ਹਾਂ ਅਤੇ ਇੱਥੇ ਨੌਕਰੀ ਵਗੈਰਾ ਮਿਲੀ ਹਾਂਜੀ ਹਾਂ ਇੱਥੇ ਬੇਰੁਜ਼ਗਾਰੀ ਤੁਹਾਨੂੰ ਪਤਾ ਜ਼ਿਆਦਾ ਆ ਜੀ ਨੌਕਰੀ ਵਗੈਰਾ ਮਿਲੀ ਨਹੀਂ ਹੈਗੀ ਬੱਚੇ ਨੇ ਪੜ੍ਹਾਈ ਬਹੁਤ ਜ਼ਿਆਦਾ ਕੀਤੀ ਸੀਗੀ ਅਤੇ ਉਹ ਕਹਿੰਦੇ ਵੀ ਇੱਥੇ ਜਦੋਂ ਹੈ ਹੀ ਨਹੀਂ ਰੁਜ਼ਗਾਰ ਕੋਈ ਤਾਂ ਉਹ ਫਿਰ ਬਾਹਰ ਸੈੱਟ ਹੋ ਗਏ ਸੀ ਜੀ ਅਸੀਂ ਬਾਹਰ ਸੈੱਟ ਕਰ ਤੇ ਸੀ ਉਹਦਾ ਮਾਮਾ ਪਹਿਲਾਂ ਬਾਹਰ ਗਿਆ ਹੋਇਆ ਸੀ ਹਾਂਜੀ ਹਾਂ ਅਤੇ ਉਹ ਫਿਰ ਉਹਨਾਂ ਨੂੰ ਉੱਧਰ ਹੀ ਲੈ ਗਿਆ ਸੀ ਅਤੇ ਉੱਧਰ ਹੁਣ ਉਹਨਾਂ ਦਾ ਵਧੀਆ ਬਿਜ਼ਨਸ ਹੈ ਜੀ ਵਧੀਆ ਸੈਟ ਨੇ ਜੀ ਉਹ ਹਾਂ ਔਰ ਆਪਣੇ ਹਾਂਜੀ ਹਾਂ ਆਪਣੇ ਸੁਣਾਓ ਆਪਣੇ ਬੱਚੇ ਕੀ ਕਰਦੇ ਨੇ ਜੀ ਅੱਛਾ ਅੱਛਾ ਹਾਂਜੀ ਹਾਂਜੀ ਹਾਂ ਇਹ ਤਾਂ ਹੈ ਜੀ ਨਹੀਂ ਮਿਲਦੇ ਹਾਂਜੀ ਬਾਕੀ ਹੁਣ ਸ ਸਰਕਾਰਾਂ ਵੀ ਰੱਖਦੀਆਂ ਨੇ ਜੀ ਐਡਹੋਕ 'ਤੇ ਰੱਖਦੀਆਂ ਨੇ ਪ੍ਰਾਈਵੇਟ ਰੱਖਦੀਆਂ ਨੇ ਜਾਂ ਕੰਟਰੈਕਟ 'ਤੇ ਰੱਖਦੀਆਂ ਨੇਗੀਆਂ ਹਾਂਜੀ ਹਾਂ ਹਾਂਜੀ ਹਾਂਜੀ ਹਾਂ ਨਹੀਂ ਸਹੀ ਗੱਲ ਆ ਹਾਂਜੀ ਹਾਂ ਹਾਂਜੀ ਹਾਂ ਇਹ ਤਾਂ ਹੈ ਸਹੀ ਗੱਲ ਹਾਂਜੀ ਹਾਂਜੀ ਹਾਂ ਮੇਰੀ ਬੇਟੀ ਨੇ ਜਦੋਂ ਕੋਲਜ ਦੇ ਵਿੱਚ ਵੀ ਟੋਪ ਕੀਤਾ ਜੀ ਹਾਂਜੀ ਹਾਂਜੀ ਹਾਂ ਹਾਂਜੀ ਹਾਂ ਨਹੀਂ ਸਹੀ ਗੱਲ ਆ ਹਾਂਜੀ ਹਾਂ ਬੱਚੇ ਇੰਨੇ ਇੰਨੇ ਵਧੀਆ ਆਪਣੇ ਬਹੁਤ ਲਾਇਕ ਸੀ ਬੱਚੇ ਉਹਨਾਂ ਨੂੰ ਕਾਲਜ ਵਿੱਚ ਵੀ ਟੋਪ ਕੀਤਾ ਸੀ ਗੋਲਡ ਮੈਡਲ ਸੀ ਬਟ ਵੱਡਾ ਬੇਟਾ ਵੱਡਾ ਬੇਟਾ ਤਾਂ ਤਾਂ ਦੇਖੋ ਉਹਨਾਂ ਨੂੰ ਵੀ ਨਹੀਂ ਸਰਕਾਰੀ ਨੌਕਰੀ ਮਿਲੀ ਹੈਗੀ ਤਾਂ ਉਹ ਨਿਰਾਸ਼ ਹੋ ਗਏ ਇੱਕ ਹਿਸਾਬ ਨਾਲ ਕਹਿੰਦੇ ਚਲ ਅਸੀਂ ਬਾਹਰ ਸੈੱਟ ਹੋ ਜਾਂਦੇ ਹਾਂ ਅਤੇ ਹਾਰ ਕੇ ਫਿਰ ਉਹਨਾਂ ਨੂੰ ਬਾਹਰ ਸੈੱਟ ਕੀਤਾ ਇੱਥੇ ਤਾਂ ਬਹੁਤ ਬੁਰਾ ਹਾਲ ਹੈ ਜੀ ਬਹੁਤ ਜ਼ਿਆਦਾ ਔਖਾ ਇੱਧਰ ਸੈਟ ਹੋਣਾ ਹਾਂਜੀ ਹਾਂਜੀ ਹੋਰ ਸੁਣਾਓ ਸਿਹਤ ਸਿਹਤ ਕਿਵੇਂ ਰਹਿੰਦੀ ਜੀ ਠੀਕ ਰਹਿੰਦੀ ਹੈ ਹਾਂਜੀ ਹਾਂ ਹਾਂਜੀ ਹਾਂਜੀ ਹਾਂ ਹਾਂ ਇਹ ਤਾਂ ਹੈ ਸਹੀ ਗੱਲ ਆ ਹਾਂਜੀ ਹਾਂਜੀ ਹਾਂਜੀ ਸਹੀ ਗੱਲ ਆ ਹਾਂਜੀ ਹਾਂਜੀ ਹਾਂ ਕਦੇ ਮਾਰਿਓ ਗੇੜਾ ਲੰਘਦੇ ਵੜਦੇ ਕਦੇ ਆਇਓ ਜੀ ਹਾਂਜੀ ਹਾਂਜੀ ਹਾਂ ਨਹੀ ਕੋਈ ਗੱਲ ਨਹੀਂ ਠੀਕ ਹੈ ਦੀਦੀ ਕੋਈ ਗੱਲ ਨਹੀਂ ਠੀਕ ਹੈ ਜੀ ਸਸ ਸਤਿ ਸ਼੍ਰੀ ਅਕਾਲ ਜੀ ਓਕੇ